ਮੈਂ ਜ਼ਿਆਦਾਤਰ ਕਿਤਾਬਾਂ ਪੜ੍ਹਨ ਦੇ ਲਈ ਮੇਰੇ ਪਿੰਡ ਦੀ ਲਾਈਬ੍ਰੇਰੀ ਦੇ ਵਿੱਚ ਹੀ ਜਾਂਦਾ ਹਾਂ ਕਿਉਂਕਿ ਉੱਥੇ ਲਾਈਬ੍ਰੇਰੀ ਦੇ ਵਿੱਚ ਮੈਨੂੰ ਫਰੀ ਕਿਤਾਬਾਂ ਪੜ੍ਹਨ ਦੇ ਲਈ ਮਿਲ ਜਾਂਦੀਆਂ ਹਨ ਅਤੇ ਫਿਰ ਮੈਂ ਕਿਤਾਬਾਂ ਪੜ੍ਹ ਕੇ ਵਾਪਸ ਦੇ ਆਉਂਦਾ ਪਰ ਜੇ ਮੈਂ ਕੋਈ ਕਿਤਾਬ ਖਰੀਦਣੀ ਹੁੰਦੀ ਹੈ ਤਾਂ ਮੈਂ ਇਹ ਕਿਤਾਬਾਂ ਔਨਲਾਈਨ ਖਰੀਦਣਾ ਪਸੰਦ ਕਰਦਾ ਹਾਂ ਅਤੇ ਔਨਲਾਈਨ ਹੀ ਉਹ ਕਿਤਾਬ ਪੜ੍ਹ ਕੇ ਮੈਂ ਵਾਪਸ ਫਿਰ ਤੋਂ ਵੇਚ ਦਿੰਦਾ ਹਾਂ ਅਤੇ ਨਾਲ ਹੀ ਮੇਰੇ ਸ਼ਹਿਰ ਦੇ ਵਿੱਚ ਇੱਕ ਵੱਡੀ ਦੁਕਾਨ ਵੀ ਹੈ ਜਿਸ ਤੋਂ ਮੈਂ ਪੁਰਾਣੀਆਂ ਕਿਤਾਬਾਂ ਖਰੀਦ ਸਕਦਾ ਜਿਸ ਦਾ ਨਾਮ ਮਿੱਤਲ ਬੁੱਕ ਡਿਪੂ ਹੈ ਉੱਥੇ ਕਾਫੀ ਘੱਟ ਅਤੇ ਵਾਜਿਬ ਰੇਟ ਦੇ ਵਿੱਚ ਪੁਰਾਣੀਆਂ ਕਿਤਾਬਾਂ ਮਿਲ ਜਾਂਦੀਆਂ ਹਨ ਜੋ ਕਿ ਕਾਫੀ ਵਧੀਆ ਹਾਲਤ ਦੇ ਵਿੱਚ ਅਤੇ ਪੜ੍ਹਨ ਦੇ ਯੋਗ ਹੁੰਦੀਆਂ ਹਨ ਸੋ ਮੈਂ ਸੈਕਿੰਡ ਹੈਂਡ ਕਿਤਾਬਾਂ ਮੇਰੇ ਸ਼ਹਿਰ ਦੇ ਵਿੱਚੋਂ ਹੀ ਮਿੱਤਲ ਬੁੱਕ ਡੀਪੂ ਤੋਂ ਖਰੀਦ ਲੈਂਦਾ ਅਤੇ ਨਵੀਆਂ ਕਿਤਾਬਾਂ ਔਨਲਾਈਨ ਖਰੀਦ ਲੈਂਦਾ ਅਤੇ ਇਸ ਤੋਂ ਵੀ ਇਲਾਵਾ ਚੰਗੀਆਂ ਕਿਤਾਬਾਂ ਜਿਵੇਂ ਕਿ ਮੈਂ ਦੱਸ ਹੀ ਚੁੱਕਿਆ ਗੁਰਦੁਆਰਾ ਸਾਹਿਬ ਦੀ ਲਾਈਬ੍ਰੇਰੀ ਅਤੇ ਪਿੰਡ ਦੀ ਲਾਈਬ੍ਰੇਰੀ ਦੇ ਵਿੱਚੋਂ ਖਰੀਦ ਲੈਂਦਾ